ਪੰਜਾਬ ਵਿੱਚ ਕਾਰੋਬਾਰ ਵਿਕਾਸ ਅਤੇ ਵਿਸਥਾਰ ਦੀ ਯੋਜਨਾ ਜੋ ਪੰਜਾਬ ਸਰਕਾਰ ਹੈ ਇਹਦਾ ਮੁੱਖ ਸੱਭਿਆਚਾਰਕ ਅਤੇ ਭਾਇਚਾਰੇ ਨੂੰ ਵਧਾਇਆ ਜਾਂਦਾ ਹੈ ਨੈੱਟਵਰਕਿੰਗ ਨੂੰ ਵਧਾਇਆ ਜਾਂਦਾ ਹੈ ਜਿਹਦੇ ਦਮ ਦੇ ਉੱਤੇ ਪਰ ਅੱਗੇ ਜੋ ਪ੍ਰਬੰਧ ਹੈ ਕੀਤੇ ਜਾਂਦੇ ਹਨ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਨਾਲ ਵੀ ਕਾਰੋਬਾਰ ਦੇ ਵਿਕਾਸ 'ਚ ਵਾਧਾ ਪੈ ਜਾਂਦਾ ਹੈ ਜਿਹੜੇ ਲੋਕ ਬਾਹਰ ਪੰਜਾਬੀ ਬਾਹਰ ਰਹਿੰਦੇ ਹੈ ਉਹ ਭਾਰ ਪੰਜਾਬ ਨੂੰ ਪੂਰੇ ਇਨਵੈਸਟਮੈਂਟ ਦੇ ਨਾਲ ਜਿਹੜਾ ਸਪੋਰਟ ਕਰਦੇ ਹਨ ਜਿਹਦੇ ਨਾਲ ਨਵੇਂ ਨਵੇਂ ਕਾਰੋਬਾਰ ਦਾ ਵਿਕਾਸ ਕੀਤਾ ਜਾਂਦਾ ਹੈ ਨਵੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਜਾਂਦਾ ਹੈ ਜਿਵੇਂ ਐਜੂਕੇਸ਼ਨ ਨੂੰ ਹੀ ਲਾ ਲਿਜੀਏ ਅਤੇ ਇਹਦੇ ਵਿੱਚ ਕੀ ਕੀ ਨਵੇਂ ਚੇਂਜਿਸ ਆਉਣੇ ਜ਼ਰੂਰੀ ਹੈ ਇਹਦੇ ਲਈ ਨਵੀਂ ਸੰਸਥਾਵਾਂ ਬਣਾਈ ਜਾਂਦੀਆਂ ਹਨ ਅਤੇ ਕੁਛ ਸੰਸਥਾਵਾਂ ਬਾਹਰ ਫੋਰਨਰ ਕੰਟਰੀਜ਼ ਉਹ ਵੀ ਮਦਦ ਕਰਦੀਆਂ ਹਨ ਕਰ ਸਕਦੀਆਂ ਨੇ ਕੋਲੈਕਟੀ ਰਿਸਪੌਂਡ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਪੈਸੇ ਪੂਸੇ ਦੀ ਅਗ ਪੰਜਾਬ ਦੇ ਵਿੱਚ ਜਿਵੇਂ ਸਪੋਰਟ ਇੰਡਸਟਰੀ ਬਹੁਤ ਜ਼ਿਆਦਾ ਵੱਡੀ ਹੈ ਅਤੇ ਸਪੋਰਟ ਇੰਡਸਟਰੀ ਅਤੇ ਲੁ ਜਲੰ ਜਲੰਧਰ ਅਤੇ ਲੁਧਿਆਣਾ ਵਿੱਚ ਕੱਪੜਾ ਜੋ ਹੈ ਉਹਦੀ ਮਾਰਕੀਟ ਬੜੀ ਵੱਡੀ ਹੈ ਅਤੇ ਇਹ ਜੋ ਬਿਜ਼ਨਸ ਹੈ ਇਹ ਵਿਸ਼ਵ ਪੱਧਰ ਉੱਤੇ ਫੈਲੇ ਹੋਏ ਹਨ ਅਤੇ ਇਹਦੇ ਲਈ ਆਪਸ ਵਿੱਚ ਵੱਡੀਆਂ ਕੰਪਨੀਆਂ ਦਾ ਬਾਹਰ ਦੀ ਕੰਪਨੀਆਂ ਦੇ ਵਿੱਚ ਤਾਲਮੇਲ ਰੱਖਿਆ ਹੁੰਦਾ ਹੈ ਤਾਲਮੇਲ ਦੇ ਜ਼ਰੀਏ ਨਵੀਂ ਨਵੀਂ ਟੈਕਨੀਕ ਨੂੰ ਲਾਗੂ ਕੀਤਾ ਜਾਂਦਾ ਹੈ ਅਤੇ ਤਾਂ ਕਿ ਜੋ ਪੰਜਾਬ ਦਾ ਕਾਰੋਬਾਰ ਹੈ ਉਹ ਵਿਸ਼ਵਸਤਰ ਤੇ ਉੱਤੇ ਇਹਦਾ ਪ੍ਰਬੰਧ ਹੋਵੇ